ਹੈਲੋ ਹਾਂਜੀ ਜਸਵਿੰਦਰ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਅੱਛਾ ਮੈਂ ਤੁਹਾਡਾ ਵਟਸਐਪ ਸਟੇਟਸ ਵੇਖਿਆ ਬਹੁਤ ਖੂਬਸੂਰਤ ਸਤਰਾਂ ਲੱਗੀਆਂ ਮੈਨੂੰ ਤੁਸੀਂ ਲਿਖਦੇ ਹੋ ਤੁਸੀਂ ਲਿਖਦੇ ਵੀ ਹੋ ਤੁਸੀਂ ਲਿਖਦੇ ਵੀ ਹੋ ਖੂਬਸੂਰਤ ਲਿਖਦੇ ਹੋ ਜੇ ਉਹ ਤੁਹਾਡੀਆਂ ਲਿਖਤਾਂ ਨੇ ਤਾਂ ਬਹੁਤ ਅੱਛਾ ਹੈ ਅਤੇ ਤੁਸੀਂ ਕਦੋਂ ਲਿਖਦੇ ਹੋ ਮਤਲਬ ਤੁਹਾਨੂੰ ਕਦੋਂ ਲੱਗਦਾ ਹੁੰਦਾ ਕਿ ਮੈਂ ਲਿਖਾਂ ਬਿਲਕੁਲ ਹੂੰ ਹੂੰ ਹੂੰ ਹਾਂਜੀ ਹੂੰ ਹੂੰ ਹੂੰ

ਮੈਨੂੰ ਹਾਂ ਮੈਨੂੰ ਤੁਹਾਡੀ ਹਾਲਾਂ ਕਿ ਮੈਂ ਲੰਬੀ ਕਵਿਤਾ ਲਿਖਦੀ ਹਾਂ ਜਾਂ ਗਜ਼ਲ ਲਿਖਦੀ ਹਾਂ ਪਰ ਤੁਹਾਡੀ ਮੈਨੂੰ ਹਾਂ ਤੁਹਾਡੀ ਵਿਸ਼ੇਸ਼ਤਾ ਮੈਨੂੰ ਇਸ ਗੱਲ 'ਚ ਲਿਖੀ ਲੱਗੀ ਕਿ ਤੁਸੀਂ ਬਹੁਤ ਛੋਟਾ ਲਿਖਦੇ ਹੋ ਪਰ ਉਹਦੇ ਜਿਹੜੇ ਭਾਵ ਹੁੰਦੇ ਆ ਨਾ ਉਹ ਬਹੁਤ ਗਹਿਰੇ ਹੁੰਦੇ ਆ ਵੈਸੇ ਵੀ ਮੈਨੂੰ ਲੱਗਦਾ ਹੈ ਕਿ ਅੱਜ ਕੱਲ੍ਹ ਬਿਲਕੁਲ ਜੀ ਹਾਂਜੀ ਹਾਂ ਹਾਂ ਬਿਲਕੁਲ ਤੁਹਾਡੀਆਂ ਤੁਕਾਂ ਪੜ੍ਹ ਕੇ ਤਾਂ ਮੈਨੂੰ ਵੀ ਇੱਕ ਤਰ੍ਹਾਂ ਦੀ ਨਾ ਮੈਂ ਇਹ ਕਹਿ ਸਕਦੀ ਹਾਂ ਪ੍ਰੇਰਣਾ ਮਿਲੀ ਸਚਮੁੱਚ ਹੀ ਕਿ ਬਹੁਤਾ ਲੰਬਾ ਲਿਖਣਾ ਜ਼ ਨਹੀ ਨਹੀਂ ਪਰ ਮੈਨੂੰ ਐਂਏ ਲੱਗਿਆ ਕਿ ਦੋ ਸ਼ਬਦਾਂ ਦੋ ਲਾਈਨਾਂ ਦੇ ਵਿੱਚ ਜੋ ਤੁਸੀਂ ਕਹਿ ਗਏ ਹੈ ਨਾ ਅਤੇ ਅੱਜ ਕੱਲ੍ਹ ਵੈਸੇ ਵੀ ਦੁਨੀਆਂ ਬਹੁਤ ਤੇਜ਼ ਹੋ ਗਈ ਹੈ ਨਾ ਸਮਾਂ ਹੀ ਨਹੀਂ ਹੈਗਾ ਕਿਸੇ ਕੋਲ ਨਾ ਜੇ ਤੁਸੀਂ ਦੋ ਸਤਰਾਂ ਦੇ ਵਿੱਚ ਸਭ ਕੁਛ ਬਿਆਨ ਕਰ ਸਕਦੇ ਹੋ ਤਾਂ ਲੰਬੀ ਕਵਿਤਾ ਲਿਖਣ ਦੀ ਸ਼ਾਇਦ ਕਿਤੇ ਲੋੜ ਹੀ ਨਹੀਂ ਰਹਿੰਦੀ ਹੈ ਨਾ ਮੈਨੂੰ ਹੂੰ ਨਹੀਂ ਮੈਨੂੰ ਤੁਹਾਡੀਆਂ ਤੁਹਾਡੀਆਂ ਤੁਕਾਂ ਸੀ ਨਾ ਉਹ ਖੁਦਖੁਸ਼ੀ ਦਾ ਫਾਇਦਾ ਗਿਣਾ ਕੇ ਤੋਫਿਆ ਚਰੱਸੀ ਭੇਜ ਦਿੱਤੀ ਮੈਨੂੰ ਬਹੁਤ ਮਤਲਬ ਮੇਰੇ ਜਿਵੇਂ ਕਹਿੰਦੇ ਹੁੰਦੇ ਨਾ ਰੂਹ 'ਚ ਉਤਰ ਗਈਆਂ ਅਤੇ ਹਾਂ ਵੇਖਣ ਵਾਲੀ ਹਾਂਜੀ ਬਹੁਤ ਅੱਛਾ ਮਤਲਬ ਹਾਂ ਲੱਗਿਆ ਮੈਨੂੰ ਹੂੰ ਹਾਲਾਂ ਕਿ ਅੱਜ ਕੱਲ੍ਹ ਸਾਡੇ ਹੂੰ ਹੂੰ ਹੂੰ ਓਏ ਹੋਏ ਹੋਏ ਹੋਏ ਹੋਏ ਹਾਂਜੀ

ਹਾਂਜੀ ਬਿਲਕੁਲ ਹੂੰ ਹੂੰ ਹੂੰ ਹੂੰ ਹੂੰ ਅੱਛੇ ਖਿਆਲ ਨੇ ਅੱਛੇ ਖਿਆਲ ਨੇ ਤੁਹਾਡੇ ਅਤੇ ਤੁਸੀਂ ਇਹਨਾਂ ਨੂੰ ਲਿਖਦੇ ਰਹੋ ਨਹੀਂ ਜੀ ਮੈਨੂੰ ਬਹੁਤ ਅੱਛੇ ਲੱਗੇ ਤੁਹਾਡੇ ਖਿਆਲ ਅਤੇ ਮੈਨੂੰ ਤਾਂ ਲੱਗਿਆ ਕਿ ਐਵੇਂ ਅਸੀਂ ਬਹਿਰਾਂ ਦੇ ਵਿੱਚ ਬੰਨੇ ਰਹਿੰਦੇ ਹਾਂ ਅਤੇ ਗਜ਼ਲਾਂ ਦੇ ਨਾਪ ਤੋਲ ਕਰਦੇ ਰਹਿੰਦੇ ਹਾਂ ਅਤੇ ਤੁਸੀਂ ਵਧੀਆ ਜਿਹੜਾ ਹੈ ਛੋਟੇ ਛੋਟੇ ਕਾਵਿ ਲਿਖ ਕੇ ਜਿਹੜਾ ਹੈ ਆਪਣੇ ਮਨ ਦੇ ਭਾਵ ਵਿਅਕਤ ਕਰਦੇ ਹੋ ਅੱਛੀ ਲਿਖਤ ਹੈ ਤੁਹਾਡੀ ਅਤੇ ਉਮੀਦ ਕਰਾਂਗੀ ਕਿ ਤੁਸੀਂ ਇਸੇ ਤਰ੍ਹਾਂ ਹੀ ਜ਼ਿੰਦਗੀ 'ਚ ਲਿਖਦੇ ਰਹੋ ਅਤੇ ਮੇਰੇ ਨਾਲ ਜਿਹੜੀਆਂ ਹੈਗੀਆਂ ਹਾਂ ਅਤੇ ਆਪਣੀਆਂ ਸਤਰਾਂ ਜਿਹੜੀਆਂ ਹਮੇਸ਼ਾ ਸਾਡੇ ਨਾਲ ਸਾਂਝੀਆਂ ਕਰਦੇ ਰਿਹੋ ਤਾਂ ਕਿ ਹਾਂਜੀ ਬਿਲਕੁਲ ਠੀਕ ਹੈ ਜੀ ਮਿਲਾਂਗੇ ਕਦੇ ਨਾ ਕਦੇ ਬੜਾ ਤੁਹਾਡੀਆਂ ਲਿਖਤਾਂ ਨੂੰ ਪੜ੍ਹ ਕੇ ਦਿਲ ਕੀਤਾ ਕਿ ਤੁਹਾਨੂੰ ਮਿਲਿਆ ਜਾਵੇ ਅਤੇ ਕਦੇ ਮਿਲ ਕੇ ਬੈਠ ਕੇ ਦੋ ਰੂਹਾਂ ਆਪਸ 'ਚ ਆਪਾਂ ਕਾਵਿ ਵੀ ਸਾਂਝੇ ਕਰਾਂਗੇ ਅਤੇ ਕਾਵਿ ਨਾਲ ਜੁੜੀਆਂ ਗੱਲਾਂ ਵੀ ਸਾਂਝੀਆਂ ਕਰਾਂਗੇ ਹੈ ਨਾ ਹੁਣ ਸਾਹਿਤ ਨੂੰ ਕੀ ਲੋੜ ਹੈ ਹੈ ਨਾ ਸਾਡੇ ਸਮਾਜ ਨੂੰ ਕੀ ਲੋੜ ਹੈ ਆਪਾਂ ਉਸ ਬਾਰੇ ਵੀ ਜ਼ਰੂਰ ਗੱਲਬਾਤ ਕਰਾਂਗੇ ਠੀਕ ਹੈ ਜੀ ਹਾਂਜੀ ਦੂਰ ਹੋ ਰਹੀ ਹੈ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਜਿਹੜਾ ਸਾਹਿਤ ਆ ਰਿਹਾ ਉਹ ਕੱਚਾ ਜਿਹਾ ਅਣਘੜਿਆ ਜਿਹਾ ਕੋਈ ਉਹਦੇ ਵਿੱਚ ਮਤਲਬ ਕੁਛ ਵੀ ਨਹੀਂ ਹੁੰਦਾ ਹੈ ਨਾ ਹਾਂਜੀ ਅਤੇ ਉਹਨਾਂ ਦਾ ਵਿਸ਼ਵਾਸ ਹੀ ਉੱਠ ਜਾਂਦਾ ਚੰਗੇ ਸਾਹਿਤ ਤੋਂ ਹਾਂਜੀ ਹਾਂ ਤਾਂ ਜਲਦੀ ਮਿਲਾਂਗੇ ਕਿਤੇ ਨਾ ਕਿਤੇ ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਆਪਾਂ ਜਲਦੀ ਮਿਲਾਂਗੇ ਅਤੇ ਕਦੇ ਇਹਨਾਂ ਬਾਰੇ ਗੱਲਬਾਤ ਕਰਾਂਗੇ ਜ਼ਰੂਰ ਠੀਕ ਹੈ ਓਕੇ